ਦਸ ਅਗਸਤ ਦੋ ਹਜ਼ਾਰ ਪੰਜ ਬਾਰਾਂ ਜਨਵਰੀ ਦੋ ਹਜ਼ਾਰ ਇੱਕ ਪੰਦਰਾਂ ਸਤੰਬਰ ਉੱਨੀ ਸੌ ਨੱਬੇ ਸੋਲਾਂ ਮਈ ਉੱਨੀ ਸੌ ਛਿਆਨਵੇਂ ਪੰਜ ਅਪ੍ਰੈਲ ਦੋ ਹਜ਼ਾਰ ਵੀਹ